ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਪ੍ਰਿੰਸ ਭਾਅ ਜੀ ਬੋਲਦੇ ਜੀ ਅਤੇ ਭਾਅ ਜੀ ਮੈਂ ਸਤਨਾਮ ਕੋਲੋਂ ਤੁਹਾਡਾ ਨੰਬਰ ਲਿਆ ਸੀਗਾ ਜੀ ਅਤੇ ਭਾਅ ਜੀ ਅਸੀਂ ਹੁਣੇ ਹੁਣੇ ਇੱਥੇ ਸ਼ਿਫਟ ਹੋਏ ਹਾਂ ਵੀ ਜਾਣੀ ਕਿ ਅਸੀਂ ਵੀ ਸਾਨੂੰ ਇੱਥੇ ਪਤਾ ਨਹੀਂ ਹੈ ਵੀ ਮਾਰਕੀਟ ਕਿੱਥੇ ਆ ਅਤੇ ਵਧੀਆ ਅਸੀਂ ਸਬਜ਼ੀਆਂ ਕਿੱਥੋਂ ਲੈ ਲਈਏ ਅਤੇ ਇੱਕ ਦੋ ਵਾਰੀ ਅਸੀਂ ਇੱਥੋਂ ਦੀ ਖਰੀਦੀਆਂ ਵੀ ਆ ਪਰ ਉੱਥੋਂ ਦੀ ਸਾਨੂੰ ਜਾਣੀ ਕਿ ਵਧੀਆ ਨਹੀਂ ਮਿਲੀਆ ਹੈਗੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਅਤੇ ਭਾਅ ਜੀ ਉਹਨਾਂ ਕੋਲੋਂ ਫਰੂਟ ਫਰਾਟ ਵੀ ਮਿਲ ਜੂਗਾ

ਠੀਕ ਹੈ

ਅਤੇ ਭਾਅ ਜੀ ਇਹਨਾਂ ਦਾ ਰੇਟ ਕੀ ਹੋਊਗਾ ਠੀਕ ਹੈ ਅਤੇ ਭਾਅ ਜੀ ਛੇਤੀ ਇਹ ਖਰਾਬ ਤਾਂ ਨਹੀਂ ਹੋਊਗੀਆਂ ਯਾਰ ਇਹ ਪਹਿਲਾਂ ਮੈਂ ਕਿਸੇ ਕੋਲੋਂ ਲਈਆਂ ਸੀਗੀਆਂ ਦੂਸਰੇ ਤੀਸਰੇ ਦਿਨੇ ਖਰਾਬ ਹੋ ਗਈਆਂ ਤਾਂ ਕਰਕੇ ਮੈਂ ਜਾਣੀ ਜਾਣੀ ਕਿ ਚਾਹੁੰਦਾ ਹਾਂ ਵੀ ਜਿੱਥੋਂ ਚੀਜ਼ ਲਈਏ ਵਧੀਆ ਲਈਏ ਸਬਜ਼ੀ ਵਧੀਆ ਹੋਵੇ ਵੀ ਛੇਤੀ ਖਰਾਬ ਹੋਣ ਵਾਲੀ ਨਾ ਹੋਵੇ ਠੀਕ ਹੈ

ਠੀਕ ਹੈ ਚਲੋ ਕੋਈ ਗੱਲ ਨਹੀਂ ਭਾਅ ਜੀ ਓਕੇ ਓਕੇ ਥੈਂਕ ਯੂ ਭਾਅ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਦੱਸਣ ਲਈ ਜੀ